ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਤੁਸੀਂ ਬਠਿੰਡੇ ਤੋਂ ਆਏ ਹੋ ਹਾਂਜੀ ਹਾਂਜੀ ਜ਼ਰੂਰ ਜੀ ਪਟਿਆਲਾ ਵਿੱਚ ਜੇ ਤੁਸੀਂ ਮੰਨ ਲਓ ਫੁਲਕਾਰੀ ਵਗੈਰਾ ਕੱਪੜੇ ਵਗੈਰਾ ਲੈਣੇ ਨੇ ਮਸ਼ਹੂਰ ਪਟਿਆਲੇ ਦੇ ਜੁੱਤੀਆਂ ਵਗੈਰਾ ਤਾਂ ਤੁਸੀਂ ਕਿਲ੍ਹਾ ਚੌਂਕ ਜਾ ਸਕਦੇ ਹੋ ਉੱਥੇ ਕਾਫੀ ਵਧੀਆ ਵਰਾਇਟੀ ਮਿਲ ਜਾਏਗੀ ਇਸ ਤੋਂ ਇਲਾਵਾ ਤੁਸੀਂ ਤੋਪਖਾਨਾ ਮੋੜ ਹੈ ਉੱਥੇ ਵੀ ਜਾ ਸਕਦੇ ਹੋ ਇਸ ਤੋਂ ਹਾਂ ਹਾਂ ਕੱਪੜੇ ਹਾਂ ਹਾਂਜੀ ਕੱਪੜੇ ਵਗੈਰਾ ਹੋਰ ਬਾਕੀ ਹੋਮ ਡੈਕੋਰੇਸ਼ਨ ਦਾ ਸਮਾਨ ਉੱਥੋਂ ਮਿਲ ਜਾਏਗਾ ਤੁਹਾਨੂੰ ਆਰਾਮ ਨਾਲ ਇਸ ਤੋਂ ਇਲਾਵਾ ਪੰਜਾਬ ਇਹ ਪਟਿਆਲੇ ਵਿੱਚ ਸ਼ੇਰ ਏ ਪੰਜਾਬ ਮਾਰਕੀਟ ਹੈ ਜਿੱਥੋਂ ਕੱਪੜੇ ਉੱਥੇ ਕੱਪੜੇ ਹੀ ਦੀਆਂ ਹੀ ਸ਼ੋਪਸ ਨੇ ਉੱਥੋਂ ਤੁਹਾਨੂੰ ਬੈਡ ਦੀਆਂ ਚਾਦਰਾਂ ਅਤੇ ਹੋਰ ਬਾਕੀ ਮਟੀਰੀਅਲ ਸਾਰਾ ਕੁਛ ਮਿਲ ਜਾਏਗਾ ਇਸ ਤੋਂ ਇਲਾਵਾ ਅਗਰ ਤੁਸੀਂ ਬ੍ਰੈਂਡਿਡ ਆਈਟਮਸ ਚਾਹੁੰਦੇ ਹੋ ਬ੍ਰੈਂਡ ਉਹ ਤੁਹਾਨੂੰ ਬਾਈ ਨੰਬਰ ਦੀ ਮਸ਼ਹੂਰ ਮਾਰਕੀਟ ਹੈ ਭੁਪਿੰਦਰ ਰੋੜ ਉੱਥੇ ਤੁਹਾਨੂੰ ਹਰੇਕ ਜਿਹੜੀ ਮੀਸ਼ੋ ਕੰਪਨੀ ਆ ਉਹਨਾਂ ਦੇ ਸ਼ੋਅਰੂਮ ਹੈਗੇ ਨੇ ਉੱਥੇ ਤੁਹਾਨੂੰ ਮਿਲ ਜਾਣਗੇ ਇਸ ਤੋਂ ਇਲਾਵਾ ਧਰਮਪੁਰਾ ਬਜ਼ਾਰ ਹੈ ਉੱਥੇ ਵੀ ਕਾਫੀ ਵਰਾਈਟੀਜ਼ ਨੇ ਉੱਥੋਂ ਤੁਸੀਂ ਲੈ ਸਕਦੇ ਹੋ ਉੱਥੇ ਕੱਪੜੇ ਫਰਨੀਚਰ ਜੁੱਤੀਆਂ ਅਤੇ ਖਾਣ ਪੀਣ ਦਾ ਸਮਾਨ ਸਾਰਾ ਉੱਥੇ ਤੁਹਾਨੂੰ ਉਪਲਬਧ ਹੋਏਗਾ ਇਸ ਤੋਂ ਇਲਾਵਾ ਲਾਹੌਰੀ ਗੇਟ ਮਾਰਕੀਟ ਹੈ ਉੱਥੇ ਵੀ ਤੁਸੀਂ ਜਾ ਸਕਦੇ ਹੋ ਅਦਾਲਤ ਬਜਾਰ ਹੈ ਚੌਂਰੰਜੀ ਬਜ਼ਾਰ ਹੈ ਵਿੱਚ ਕਾਫੀ ਮਸ਼ਹੂਰ ਨੇ ਇਸ ਤੋਂ ਇਲਾਵਾ ਅਗਰ ਤੁਸੀਂ ਹੋਰ ਵਰਾਇਟੀ ਚਾਹੁੰਦੇ ਹੋ ਤਾਂ ਤ੍ਰਿਪੜੀ ਹੈ ਤ੍ਰਿਪੜੀ ਵੀ ਮਸ਼ਹੂਰ ਮਾਰਕੀਟ ਹੈ ਉੱਥੇ ਤੁਹਾਨੂੰ ਕੱਪੜੇ ਕਢਾਈ ਅਤੇ ਸਾਰਾ ਕੁਛ ਜੋ ਵੀ ਹੋਮ ਘਰ ਦਾ ਸਮਾਨ ਉਹ ਸਾਰਾ ਕੁਛ ਮਿਲ ਜਾਏਗਾ

ਹਾਂਜੀ ਇੱਥੇ ਮਸ਼ਹੂਰ ਤਾਂ ਪੰਜਾਬੀ ਜੁੱਤੀ ਹੈ ਅਤੇ ਹੋਰ ਪਰਾਂਦੀਆਂ ਨੇ ਫੁਲਕਾਰੀ ਹੈ ਇਹ ਤੁਹਾਨੂੰ ਕਿਲ੍ਹਾ ਚੌਂਕ ਦੇ ਨੇੜੇ ਲਾਗੇ ਸ਼ਾਗੇ ਸਾਰੀਆਂ ਚੀਜ਼ਾਂ ਤੁਹਾਨੂੰ ਉਪਲਬਧ ਹੋ ਜਾਣਗੀਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਬਹੁਤ ਖੁਸ਼ੀ ਹੋਵੇਗੀ ਠੀਕ ਹੈ ਜੀ ਓਕੇ ਧਨ ਧੰਨਵਾਦ ਜੀ ਬਹੁਤ